ਸਤਿ ਸ੍ਰੀ ਅਕਾਲ ਸਰ ਮੈਂ ਆਪਣੇ ਡੀਜੀ ਲੋਕਰ ਦਾ ਮੋਬਾਈਲ ਨੰਬਰ ਅਪਡੇਟ ਕਰਾਉਣਾ ਚਾਹੁੰਦਾ ਹਾਂ ਕਿਉਂਕਿ ਮੈਂ ਇੱਕ ਫਰੀਲੈਂਸਰ ਕੰਮ ਵਿੱਚ ਕੰਮ ਕਰਦਾ ਅਤੇ ਉਸ ਲਈ ਮੈਨੂੰ ਇਸ ਦੀ ਲੋੜ ਪਈ ਹੈ ਅਤੇ ਮੈਂ ਇਸ ਨੂੰ ਅਪਡੇਟ ਕਰਾਉਣਾ ਚਾਹੁੰਦਾ ਹਾਂ ਇਸ ਲਈ ਮੈਂ ਤੁਹਾਨੂੰ ਇਹ ਆਡੀਓ ਮੈਸੇਜ ਭੇਜ ਰਿਹਾ ਤਾਂ ਇਸ ਵਿੱਚ ਤੁਸੀਂ ਮੈਨੂੰ ਇਸ ਦੀਆਂ ਸਿਫਾਰਿਸ਼ਾਂ ਜੋ ਕਿ ਇਸ ਲਈ ਜ਼ਰੂਰੀ ਦਸਤਾਵੇਜ਼ ਜਾਂ ਜ਼ਰੂਰੀ ਕੰਮ ਦੱਸ ਦਿਓ